ਵਪਾਰ ਬਿਜਨਸ ਵਪਾਰ ਦੇ ਵਿੱਚ ਸਾਨੂੰ ਅਗਰ ਜੇ ਕੋਈ ਸਾਡਾ ਦੋਸਤ ਜਾਂ ਸਾਡਾ ਕੋਈ ਆਪਣਾ ਭੈਣ ਭਰਾ ਵਪਾਰ ਕਰਦਾ ਹੈ ਤਾਂ ਨਵਾਂ ਵਪਾਰ ਕਰਦਾ ਹੈ ਤਾਂ ਸਾਨੂੰ ਉਸਦਾ ਸਮਰਥਨ ਕਰਨਾ ਚਾਹੀਦਾ ਹੈ ਜਿਵੇਂ ਕਿ ਸਮਰਥਨ ਸਾਨੂੰ ਸੋਸ਼ਲ ਮੀਡੀਆ ਦੇ ਉੱਤੇ ਸਟੋਰੀਆਂ ਫੇਸਬੁਕ ਪੇਜ ਦੇ ਉੱਤੇ ਉਸ ਦੀ ਸ਼ੋਪ ਦਾ ਨਾਮ ਅਤੇ ਜੋ ਆਈਟਮ ਉਸ ਕੋਲ ਪ੍ਰੋਵਾਈਡ ਹੁੰਦੀਆਂ ਹਨ ਉਹਨਾਂ ਦੀ ਸਟੋਰੀ ਪਾ ਕੇ ਸਾਨੂੰ ਉਸਦੀ ਐਡ ਕਰਨੀ ਚਾਹੀਦੀ ਹੈ ਤਾਂ ਜੋ ਉਸਦਾ ਵਪਾਰ ਚੱਲ ਸਕੇ ਤਾਂ ਜੋ ਉਹ ਕਾਮਯਾਬ ਹੋ ਸਕੇ ਤਾਂ ਜੋ ਸਾਂਝ ਭਾਈਚਾਰਾ ਬਣਿਆ ਰਹੇ ਅਤੇ ਸਾਨੂੰ ਆਪਣੇ ਦੋਸਤਾਂ ਨੂੰ ਅਤੇ ਆਪਣੇ ਪਰਿਵਾਰ ਰਿਸ਼ਤੇਦਾਰਾਂ ਨੂੰ ਵੀ ਇਹ ਅਪੀਲ ਕਰਨੀ ਚਾਹੀਦੀ ਹੈ ਕਿ ਮੇਰੇ ਦੋਸਤ ਨੇ ਇੱਕ ਨਵਾਂ ਬਿਜ਼ਨਸ ਸ਼ੁਰੂ ਕੀਤਾ ਹੈ ਤੁਸੀਂ ਇੱਕ ਵਾਰ ਉਸ ਕੋਲ ਜ਼ਰੂਰ ਜਾ ਕੇ ਵੇਖਿਓ ਤੁਹਾਨੂੰ ਬਹੁਤ ਹੀ ਚੰਗੇ ਰੇਟਾਂ ਦੇ ਵਿੱਚ ਅਤੇ ਵਧੀਆ ਚੀਜ਼ ਮਿਲੇਗੀ ਸੋ ਸਾਨੂੰ ਸਾਂਝ ਅਤੇ ਭਾਈਚਾਰਾ ਬਰਕਰਾਰ ਰੱਖਦੇ ਹੋਏ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਇਸ ਨਾਲ ਵਪਾਰ ਵੀ ਵੱਧ ਤੋਂ ਵੱਧ ਵਧਦਾ ਹੈ